ਮੈਨੂੰ ਕਿਤਾਬਾਂ ਪੜ੍ਹਨੀਆਂ ਬਹੁਤ ਪਸੰਦ ਆ ਬਟ ਜੇ ਮੈਂ ਆਪਣੀ ਪਸੰਦੀਦਾ ਸ਼ੈਲੀਆਂ ਦੇ ਬਾਰੇ 'ਚ ਗੱਲ ਕਰਾਂ ਤਾਂ ਮੈਨੂੰ ਨੋਵਲਸ ਪੜ੍ਹਨੇ ਬਹੁਤ ਪਸੰਦ ਆ ਚਾਹੇ ਉਹ ਪੰਜਾਬੀ ਵਿੱਚ ਹੋਣ ਚਾਹੇ ਇੰਗਲਿਸ਼ ਦੇ ਵਿੱਚ ਹੋਣ ਮ ਨੋਵਲਸ ਪੜ੍ਹਨਾ ਮੇਰੀ ਸਭ ਤੋਂ ਪਸੰਦੀਦਾ ਜਿਹੜੀ ਚੀਜ਼ ਹੈ ਮੈਂ ਪੰਜਾਬੀ ਦੇ ਨੋਵਲ ਵੀ ਬਹੁਤ ਪੜ੍ਹੇ ਆ ਬਟ ਜੇ ਮੈਨੂੰ ਕਿਹਾ ਜਾਵੇ ਕੀ ਤੁਸੀਂ ਜ਼ਿੰਦਗੀ ਦੇ ਵਿੱਚ ਸਿਰਫ ਇੱਕ ਹੀ ਸ਼ੈਲੀ ਦੀਆਂ ਕਿਤਾਬਾਂ ਪੜ੍ਹਨੀਆਂ ਏ ਆ ਤਾਂ ਮੈਂ ਪ੍ਰੈਫਰ ਕਰਾਂਗੀ ਰੋਮੈਂਟਿਕ ਨੋਵਲ ਜਾਂ ਫਿਰ ਸਸਪੈਂਸ ਵਾਲੇ ਨੋਵਲਸ ਅਤੇ ਜੇ ਮੈਂ ਆਪਣੇ ਲਾਸਟ 'ਚ ਨਾਵਲ ਦੀ ਗੱਲ ਕਰਾਂ ਤਾਂ ਜਿਹੜੀ ਮੈਂ ਕਿਤਾਬ ਪੜ੍ਹੀ ਆ ਉਹ ਸੀ ਸਿਡਨੀ ਸ਼ੈਲਡਨ ਦੀ ਇਫ ਟਮੋਰੋ ਕੋਮਸ ਇਹ ਇੱਕ ਕੁੜੀ ਦੀ ਸਟੋਰੀ ਆ ਜਿਹਦੇ ਵਿੱਚ ਉਹ ਕਿੱਦਾਂ ਅਲੱਗ ਅਲੱਗ ਪ੍ਰਸਥਿਤੀਆਂ ਦੇ ਵਿੱਚੋਂ ਹੁੰਦੀ ਹੋਈ ਕਿੱਦਾਂ ਆਪਣੀ ਲਾਈਫ ਇੱਕ ਚੋਰ ਦੇ ਵਜੋਂ ਸਟਾਰਟ ਕਰਨੀ ਪੈਂਦੀ ਹੈ ਉਹਨੂੰ ਅਤੇ ਉਹ ਇੰਨੀ ਜ਼ਿਆਦਾ ਚੁਣੌਤੀਆਂ ਦਾ ਸਾਹਮਣਾ ਕਰਦੇ ਹੋਏ ਕਿੱਦਾਂ ਆਪਣੀ ਲਾਈਫ ਨੂੰ ਚੇਂਜ ਕਰਦੀ ਹੈ ਤਾਂ ਫਿਰ ਇੱਕ ਚੋਰ ਤੋਂ ਇੱਕ ਵਧੀਆ ਪਰਸਨ ਬਣ ਜਾਂਦੀ ਆ ਇਹਦੇ ਬਾਰੇ ਵਿੱਚ ਸਟੋਰੀ ਆ ਅਤੇ ਇਹ ਇੰਨੀ ਕੁ ਦਿਲਚਸਪਸ ਦਿਲਚਸਪ ਕਹਾਣੀ ਹੈ ਕਿ ਇਹਨੂੰ ਪੜ੍ਹ ਕੇ ਮਤਲਬ ਮੈਂ ਇੱਕ ਵਾਰ ਵੀ ਬੋਰ ਨਹੀਂ ਹੋਈ ਅਤੇ ਮੈਂ ਇਹਨੂੰ ਦੁਬਾਰਾ ਤੋਂ ਪੜ੍ਹਨਾ ਚਾਹੂੰਗੀ ਇਹ ਇੱਕ ਸਸਪੈਂਸ ਵਾਲਾ ਨੋਵਲ ਹੈ ਜਿਹਦੇ ਵਿੱਚ ਹਰ ਘੜੀ ਤੁਹਾਨੂੰ ਲੱਗਦਾ ਹੈ ਕਿ ਕੁੜੀ ਚੋਰੀ ਕਰਦੀ ਹੋਈ ਫੜੀ ਜਾਏਗੀ ਬਟ ਇਨ ਦਾ ਐਂਡ ਉਹ ਕਿਸੇ ਨਾ ਕਿਸੇ ਤਰੀਕੇ ਨਾਲ ਬਚ ਜਾਂਦੀ ਹੈ ਅਤੇ ਉੱਥੋਂ ਬਚਣ ਤੋਂ ਬਾਅਦ ਇੰਨੀਆਂ ਚੋਰੀਆਂ ਕਰਨ ਤੋਂ ਬਾਅਦ ਫਿਰ ਉਹ ਕਿੱਦਾਂ ਆਪਣੀ ਜ਼ਿੰਦਗੀ 'ਚ ਸੁਧਾਰ ਲੈ ਕੇ ਆਉਂਦੀ ਹੈ ਅਤੇ ਕਿੱਦਾਂ ਇੱਕ ਨੋਰਮਲ ਕੁੜੀ ਦੀ ਲਾਈਫ ਜੀਣਾ ਸ਼ੁਰੂ ਕਰ ਦਿੰਦੀ ਹੈ ਇਹਦੇ ਬਾਰੇ 'ਚ ਸਟੋਰੀ ਹੈ ਅਤੇ ਮੈਨੂੰ ਲੱਗਦਾ ਕਿ ਹਰ ਇੱਕ ਕੁੜੀ ਨੂੰ ਇਹ ਸਟੋਰੀ ਜ਼ਰੂਰ ਪੜ੍ਹਨੀ ਚਾਹੀਦੀ ਆ ਬਿਕੋਜ਼ ਇਹ ਬਹੁਤ ਹੀ ਇੱਕ ਮੋਟੀਵੇਸ਼ਨਲ ਸਟੋਰੀ ਹੈ ਜਿਹੜੀ ਕਿ ਇੱਕ ਕੁੜੀ ਨੂੰ ਆਪਣੀ ਲਾਈਫ ਦੇ ਵਿੱਚ ਜਿਹੜੀਆਂ ਵੀ ਕੰਡੀਸ਼ਨਸ ਮੁਸ਼ਕਿਲਾਂ ਆਉਂਦੀਆਂ ਆ ਉਹਨਾਂ ਨੂੰ ਉਹ ਕਿੱਦਾਂ ਪਾਰ ਕਰ ਸਕਦੀ ਹੈ ਅਤੇ ਕਿੱਦਾਂ ਆਪਣੀ ਜ਼ਿੰਦਗੀ ਨੂੰ ਦੁਬਾਰਾ ਪਹਿਲਾਂ ਵਾਂਗ ਬਣਾ ਸਕਦੀ ਹੈ ਉਹਦੇ ਬਾਰੇ 'ਚ ਇਹ ਸਟੋਰੀ ਹੈ